ਹਾਂਜੀ ਦੱਸੋ ਹਾਂਜੀ ਠੀਕ ਹੈ ਕਿਸ ਚੀਜ਼ ਲਈ ਤੁਹਾਨੂੰ ਚਾਹੀਦਾ ਜੀ ਕਿਸ ਚੀਜ਼ ਦੇ ਉੱਤੇ ਆਰਟੀਕਲ ਕਰਨਾ ਹਾਂਜੀ ਹਾਂਜੀ ਪੁੱਛੋ ਢਾਈ ਸੌ ਐਮ ਐਲ ਟੁ ਫਿਫਟੀ ਢੇਡ ਸੌ ਪਿਛਲੇ ਪਿਛਲੇ ਪੰਜ ਸਾਲ ਦਾ ਕਿਉਂਕਿ ਹਰ 'ਚ ਵੱਖਰਾ ਹੁੰਦਾ ਸੀ ਐਵਰੇਜ ਤਾਂ ਤੁਹਾਨੂੰ ਦੱਸ ਤੀ ਜੇ ਤੁਹਾਨੂੰ ਜ਼ਿਆਦਾ ਚਾਹੀਦੀ ਸਾਡੀ ਮੇਲ ਜੀ ਬਿਲਕੁਲ ਹਾਂਜੀ ਸਰ ਜਦੋਂ ਪਿਛਲੇ ਸਾਲ ਬਾੜ ਆਈ ਸੀ ਤਾਂ ਦਿਨ ਬਹੁਤ ਜ਼ਿਆਦਾ ਫਸਲ ਖ਼ਰਾਬ ਹੋ ਗਈ ਸੀ ਹਾਂ ਉਦੋਂ ਸਰਕਾਰ ਨੇ ਗਰਾਂਟ ਦਿੱਤੀ ਸੀ ਕਨਾਲਾਂ ਬਣਾਉਣ ਵਾਸਤੇ ਐਂਟੀ ਫਲੈਡਿੰਗ ਕਨਾਲਾਂ ਅਤੇ ਉਹ ਪਿਛਲੇ ਸਾਲ ਅਸੀਂ ਕਿ ਕਿਸ ਚੀਜ਼ ਲਈ ਨਹੀਂ ਸਰ ਡੈਮ ਡੈਮ ਦਾ ਸਾਨੂੰ ਕੋਈ ਨਹੀਂ ਆਈ ਇਰੀਗੇਸ਼ਨ ਡਿਪਾਰਟਮੈਂਟ ਤੋਂ ਨਹੀਂ ਕੁਛ ਆਇਆ ਤੁਹਾਨੂੰ ਰਿਵਰ ਡਿਪਾਰਟਮੈਂਟ ਜਾਂ ਫੋਰੇਸਟ ਡਿਪਾਰਟਮੈਂਟ ਤੋਂ ਪੁੱਛਣਾ ਹੋਵੇਗਾ ਹਾਂਜੀ ਸਰ ਸੱਠ ਕਰੋੜ ਆਈ ਸੀ ਹਾਂਜੀ ਕਨਾਲ ਵਾਸਤੇ ਅਤੇ ਉਹਦੀ ਕੰਸਟਰਕਸ਼ਨ ਹਲ ਚੱਲ ਰਹੀ ਹੈ ਹਾਂਜੀ ਠੀਕ ਹੈ ਜੀ